ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਉਸ ਕਿਤਾਬ ਬਾਰੇ ਉਸ ਕਿਤਾਬ ਵਿਚਲੀ ਉਸ ਕਹਾਣੀ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੀ ਜਿਸ ਬਾਰੇ ਪਹਿਲਾਂ ਤਾਂ ਮੈਨੂੰ ਇੰਨਾਂ ਰੁਝਾਨ ਨਹੀਂ ਸੀ ਉਹ ਕਿਤਾਬ ਮੈਨੂੰ ਇੰਨੀ ਪਸੰਦ ਨਾ ਲੱਗੀ ਪਰ ਮੈਂ ਬਾਅਦ ਵਿੱਚ ਉਸਨੂੰ ਪੂਰਾ ਅਖੀਰ ਤੱਕ ਪੜ੍ਹਿਆ ਵੈਸੇ ਤਾਂ ਮੈਨੂੰ ਕਿਤਾਬਾਂ ਪੜ੍ਹਨ ਮੋਬਾਇਲ 'ਤੇ ਛੋਟੇ ਛੋਟੇ ਵੀਡੀਓ ਦੇਖਣ ਵਲੋਗ ਦੇਖਣ ਦਾ ਸ਼ੌਂਕ ਹੈ ਇਸੇ ਤਰ੍ਹਾਂ ਹੀ ਮੈਨੂੰ ਇੱਕ ਸ਼ੌਂਕ ਸੀ ਕਿਤਾਬਾਂ ਪੜ੍ਹਨ ਦਾ ਵੀ ਇੱਕ ਦਿਨ ਮੈਂ ਘਰ ਵਿਹਲੀ ਬੈਠੀ ਸੀ ਘਰ ਕੋਈ ਨਹੀਂ ਸੀ ਅਤੇ ਮੈਂ ਬੋਰ ਵੀ ਹੋ ਰਹੀ ਸੀ ਘਰ ਦਾ ਕੰਮ ਸਾਰਾ ਖ਼ਤਮ ਕਰ ਚੁੱਕੀ ਸੀ ਉਨ੍ਹਾਂ ਦਿਨਾਂ ਵਿੱਚ ਮੈਂ ਬਜ਼ਾਰ ਵੀ ਨਾ ਜਾ ਸਕੀ ਗੁਰਦੁਆਰੇ ਵੀ ਨਾ ਜਾ ਸਕੀ ਕਿਉਂਕਿ ਲੋਕਡੌਨ ਸਨ ਅਤੇ ਬਜ਼ਾਰ ਵੀ ਬੰਦ ਸਨ ਅਤੇ ਵੈਸੇ ਵੀ ਪੂਰਾ ਲੋਕ ਪਰਹੇਜ਼ ਕਰਦੇ ਸਨ ਬਾਹਰ ਜਾਣ ਤੋਂ ਕਰੋਨਾ ਦਾ ਦੌਰ ਸੀ ਅਜਿਹੇ ਸਮੇਂ 'ਚ ਮੈਂ ਘਰ ਦੀ ਸਫ਼ਾਈ ਕਰਦਿਆਂ ਮੈਨੂੰ ਇੱਕ ਕਿਤਾਬ ਮਿਲੀ ਜਿਹੜੀ ਕਿ ਮੈਂ ਪਹਿਲਾਂ ਥੋੜ੍ਹੀ ਜਿਹੀ ਪੜ੍ਹ ਕੇ ਬੰਦ ਕਰ ਚੁੱਕੀ ਸਾਂ ਉਸਨੂੰ ਅੱਗੇ ਨਹੀਂ ਸੀ ਪੜ੍ਹਿਆ ਮੈਨੂੰ ਇੰਨੀ ਕਹਾਣੀ ਉਹਦੀ ਬੋਰਿੰਗ ਜਿਹੀ ਲੱਗੀ ਸੀ ਸ਼ੁਰੂ ਤੋਂ ਫਿਰ ਮੈਂ ਟੈਮ ਪਾਸ ਕਰਦੇ ਰੋਜ਼ ਸੋ ਦੌਰ ਵਿੱਚ ਹੀ ਉਹਨੂੰ ਅੱਗੇ ਪੜ੍ਹਨਾ ਸ਼ੁਰੂ ਕੀਤਾ ਥੋੜ੍ਹੀ ਅੱਗੇ ਪੜ੍ਹਿਆ ਤਾਂ ਉਹ ਕਹਾਣੀ ਥੋੜ੍ਹੀ ਮੈਨੂੰ ਇੰਟਰਸਟਿੰਗ ਲੱਗੀ ਮੇਰਾ ਮਨ ਕੀਤਾ ਕਿ ਇਸਨੂੰ ਹੋਰ ਅੱਗੇ ਪੜ੍ਹਿਆ ਜਾਵੇ ਜਿਉਂ ਜਿਉਂ ਮੈਂ ਕਹਾਣੀ ਪੜ੍ਹਦੀ ਗਈ ਤਾਂ ਮੈਨੂੰ ਬਹੁਤ ਹੀ ਕਹਾਣੀ ਵਧੀਆ ਲੱਗੀ ਉਸ ਵਿਚਲੀ ਔਰਤ ਦਾ ਕਿਰਦਾਰ ਦਰਦ ਭਰਿਆ ਸੀ ਮੈਨੂੰ ਉਸ ਔਰਤ ਨਾਲ ਹਮਦਰਦੀ ਹੋਣ ਲੱਗੀ ਉਹ ਕਿਰਦਾਰ ਕੀ ਸੀ ਉਹ ਔਰਤ ਇੱਕ ਘਰੇਲੂ ਔਰਤ ਸੀ ਜਿਹਨੇ ਕਿ ਆਪਣੇ ਬੱਚਿਆਂ ਨੂੰ ਪਾਲਿਆ ਪੋਸਿਆ ਆਪਣੇ ਪਤੀ ਨਾਲ ਵੀ ਪੂਰਾ ਪਿਆਰ ਕਰਦੀ ਸੀ ਪਰ ਉਸਦਾ ਪਤੀ ਬਾਹਰ ਕਿਸੇ ਹੋਰ ਔਰਤ ਨਾਲ ਆਪਣੇ ਸੰਬੰਧ ਬਣਾ ਕੇ ਬੈਠਾ ਸੀ ਅਤੇ ਆਪਣੀ ਔਰਤ ਨੂੰ ਜਿਹੜੀ ਕਿ ਘਰੇਲੂ ਔਰਤ ਸੀ ਉਸਨੂੰ ਨਾ ਪਸੰਦ ਕਰ ਰਿਹਾ ਸੀ ਉਹ ਔ ਔਰਤ ਫਿਰ ਵੀ ਆਪਣੇ ਘਰ ਨੂੰ ਸਾਂਭਦੀ ਹੋਈ ਆਪਣੇ ਬੱਚਿਆਂ ਵਿੱਚ ਆਪਣੇ ਘਰ ਵਿੱਚ ਦੁਖੀ ਮਨ ਨਾਲ ਰਹਿ ਰਹੀ ਸੀ ਹਰ ਸਮੇਂ ਉਹ ਉਸਦਾ ਪਤੀ ਉਸਨੂੰ ਤਾਨੇ ਮਹਿਨੇ ਮਾਰਨ ਦਾ ਕੋਈ ਵੀ ਮੌਕਾ ਹੱਥੋਂ ਨਾ ਖੁਸਾਓਂਦਾ ਉਹ ਹਰ ਤਰ੍ਹਾਂ ਦੇ ਤਾਨੇ ਮਹਿਨੇ ਚੁੱਪ ਕਰਕੇ ਸਹਿ ਲੈਂਦੀ ਅੰਦਰ ਹੀ ਅੰਦਰ ਰੋਂਦੀ ਰਹਿੰਦੀ ਬੱਚਿਆਂ ਸਾਹਮਣੇ ਆਪਣਾ ਰੋਣਾ ਵੀ ਜ਼ਾਹਿਰ ਨਾ ਕਰਦੀ ਰਾਤ ਨੂੰ ਸੌਣ ਦੇ ਸਮੇਂ ਬਿਸਤਰੇ 'ਤੇ ਪਈ ਪਈ ਆਪਣੇ ਉਹ ਅੱਥਰੂ ਬਾਹਰ ਕੱਢ ਲੈਂਦੀ ਜੋ ਕਿ ਉਸਨੇ ਸਾਰਾ ਦਿਨ ਆਪਣੇ ਅੰਦਰ ਛੁਪਾ ਕੇ ਰੱਖੇ ਹੋਏ ਹੁੰਦੇ ਸਨ ਮੈਨੂੰ ਉਹ ਕਹਾਣੀ ਬਹੁਤ ਹੀ ਵਧੀਆ ਲੱਗੀ ਉਸ ਔਰਤ ਨਾਲ ਹਮਦਰਦੀ ਵੀ ਹੋਈ ਉਸ ਆਦਮੀ ਪ੍ਰਤੀ ਨਫ਼ਰਤ ਵੀ ਹੋਈ ਜਿਹਨੇ ਕਿ ਆਪਣੀ ਔਰਤ ਨੂੰ ਧੋਖਾ ਦੇ ਕੇ ਕਿਸੇ ਦੂਜੇ ਨਾਲ ਸੰਬੰਧ ਬਣਾਏ ਹੋਏ ਸਨ ਕਿ ਇਹ ਇਸ ਤਰ੍ਹਾਂ ਕਰਨਾ ਘਰ ਵਾਸਤੇ ਹਨ ਕਿ ਜਿਹੜੀਆਂ ਘਰੇਲੂ ਔਰਤਾਂ ਹੁੰਦੀਆਂ ਹਨ ਕੀ ਗੱਲ ਉਹ ਔਰਤਾਂ ਨਹੀਂ ਹੁੰਦੀਆਂ ਅਜਿਹੀ ਸੋਚ ਬੰਦਿਆਂ ਦੀ ਨਹੀਂ ਹੋਣੀ ਚਾਹੀਦੀ ਜੀ ਧੰਨਵਾਦ